ਪਿਛਲੇ ਸਾਲਾਂ ਵਿੱਚ ਲੁਧਿਆਣੇ ਵਿੱਚ ਬਹੁਤ ਤਬਦੀਲੀਆਂ ਆਈਆਂ ਇਹ ਬਹੁਤ ਵਧੀਆ ਵਧੀਆ ਸਕੂਲ ਖੁੱਲ੍ਹੇ ਆ ਮੋਲ ਖੁੱਲ੍ਹੇ ਆ ਇਹਦੀਆਂ ਸੜਕਾਂ ਮਤਲਬ ਹਰ ਇੱਕ ਚੀਜ਼ ਪਾਰਕਾਂ ਸਾਡੇ ਘਰ ਦੇ ਨੇੜੇ ਪਾਰਕ ਆ ਗੋਲਡਨ ਪਾਰਕ ਬਹੁਤ ਅੱਛੀ ਪਾਰਕ ਆ ਹਰ ਇੱਕ ਉਹਦੇ 'ਚ ਚੀਜ਼ ਆ ਮਤਲਬ ਡਿਸਪੈਂਸਰੀਆਂ ਖੁੱਲ੍ਹੀਆਂ ਵਾਂ ਅਤੇ ਬਹੁਤ ਵਧੀਆ ਕੰਮ ਕਰ ਰਹੇ ਆ ਸਰਕਾਰ ਲੁਧਿਆਣਾ ਜ਼ਿਲ੍ਹਾ ਅੱਗੇ ਨਾਲੋਂ ਬਹੁਤ ਬਦਲਿਆ ਵਾ ਸਟੇਸ਼ਨ ਰੇਲਵੇ ਸਟੇਸ਼ਨ ਬੱਸ ਸਟੈਂਡ ਮਤਲਬ ਉਹਨਾਂ ਨੂੰ ਦੇਖੋ ਕਿ ਤੁਸੀਂ ਦੇਖਦੇ ਹੀ ਰਹਿ ਜਾਓਗੇ ਹੈ ਨਾ ਕਿ ਇੰਨਾ ਵਧੀਆ ਤਰੀਕੇ ਨਾਲ ਉਹਨੂੰ ਉਸਾਰਿਆ ਜਾ ਰਿਹਾ ਵਾ ਕਿ ਉਹ ਲੁਧਿਆਣਾ ਰਿਹਾ ਹੀ ਨਹੀਂ ਅਤੇ ਵੱਡੇ ਵੱਡੇ ਮੋਲ ਦੇਖੋ ਹੈ ਨਾ ਅੱਜ ਕੱਲ੍ਹ ਗੁਰਦੁਆਰੇ ਵੀ ਮਤਲਬ ਬਹੁਤ ਵਧੀਆ ਵਧੀਆ ਹੋ ਰਹੇ ਆ ਕਿ ਲੁਧਿਆਣੇ 'ਚ ਬਹੁਤ ਸੁਧਾਰ ਹੋਇਆ ਖ਼ਾਸ ਕਰਕੇ ਸੜਕਾਂ ਦਾ ਬਹੁਤ ਸੁਧਾਰ ਹੋਇਆ ਆ ਕੀ ਜਿੰਨਾ ਕਹਿ ਲਓ ਕਿ ਹਰ ਇੱਕ ਚੀਜ਼ ਮਤਲਬ ਲੁਧਿਆਣੇ 'ਚ ਅੱਗੇ ਨਾਲੋਂ ਬਿਹਤਰੀ ਜੇ ਅੱਜ ਤੋਂ ਪੰਜ ਸਾਲ ਪਹਿਲਾਂ ਦੀ ਵੀ ਗੱਲ ਕਰੀਏ ਅਤੇ ਹੁਣ ਦੀ ਗੱਲ ਕਰੀਏ ਹਰ ਇੱਕ ਚੀਜ਼ ਦਾ ਸੁਧਾਰ ਹੋਇਆ ਵਾ ਟਰੈਫਿਕ 'ਚ ਹਰ ਇੱਕ 'ਚ ਹੋਸਪਿਟਲਾਂ 'ਚ ਮਤਲਬ ਹਰ ਇੱਕ ਸਰਕਾਰ ਨੇ ਬਹੁਤ ਵਧੀਆ ਮਤਲਬ ਲੁਧਿਆਣੇ ਜ਼ਿਲ੍ਹੇ ਦਾ ਕੰਮ ਕੀਤਾ ਵਾ ਅਤੇ ਵਧੀਆ ਤਰੀਕੇ ਨਾਲ ਮਤਲਬ ਲੁਧਿਆਣੇ ਸ਼ਹਿਰ 'ਚ ਅੱਜ ਕੱਲ੍ਹ ਜੋ ਵੀ ਜੋ ਚੱਲ ਰਿਹਾ ਹੈ ਖ਼ਾਸ ਕਰਕੇ ਕਿ ਲੁਧਿਆਣਾ ਸ਼ਹਿਰ ਜ਼ਿਲ੍ਹਾ ਬਹੁਤ ਵਧੀਆ ਲੱਗਦਾ ਵਾ